ਸਤਿ ਸ਼੍ਰੀ ਅਕਾਲ ਜੀ ਸ ਮੈਂ ਅੱਜ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਮੈਂ ਆਪਣੇ ਸਵੈਟਰ ਬਣਾਉਣ ਲਈ ਡਿਜ਼ਾਇਨ ਅਤੇ ਪੈਟਰਨ ਕਿਵੇਂ ਚੁਣਿਆ ਪਹਿਲੇ ਤਾਂ ਮੇਰੀ ਸੱਸ ਮਾਂ ਜਿਹੜੀ ਉਹ ਕਿੰਨੇ ਦੇਰ ਤੋਂ ਹੀ ਸਵੈਟਰ ਬਣਾਉਂਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਕਈ ਪ੍ਰਕਾਰ ਦੇ ਡਿਜ਼ਾਇਨ ਆਉਂਦੇ ਹਨ ਪਹਿਲਾਂ ਤਾਂ ਮੈਂ ਬੜੀ ਬੜੀ ਬੜੀ ਬੁਣਤੀ ਨਹੀਂ ਨਹੀਂ ਆਉਂਦੀ ਸੀ ਅਤੇ ਮੈਂ ਉਹਨਾਂ ਕੋਲ ਬਹਿ ਕੇ ਸਿੱਧਾ ਪੁੱਠਾ ਸਿੱਖਿਆ ਸਿੱਖਿਆ ਸਿੱਖਣ ਤੋਂ ਬਾਅਦ ਉਹਨਾਂ ਨੂੰ ਮੈਂ ਕਈ ਪ੍ਰਕਾਰ ਦੇ ਡਿਜ਼ਾਇਨ ਸਿਖਾਏ ਅਤੇ ਬੜੇ ਹੀ ਪਰੇਸ਼ਾਨ ਸੀ ਮੈਂ ਆਪਣੇ ਬੱਚੇ ਵਾਸਤੇ ਇੱਕ ਸਵੈਟਰ ਬਣਾਉਣਾ ਚਾਹੁੰਦੀ ਸੀ ਅਤੇ ਮੈਂ ਉਹਨਾਂ ਨੇ ਕਈ ਤਰ੍ਹਾਂ ਦੇ ਡਿਜ਼ਾਈਨ ਦਿਖਾਏ ਅਤੇ ਫਿਰ ਮੈਨੂੰ ਉਹਨਾਂ 'ਚੋਂ ਇੱਕ ਪਸੰਦ ਆਇਆ ਅਤੇ ਫਿਰ ਮੈਂ ਉਹ ਡਿਜ਼ਾਇਨ ਲਾ ਕੇ ਆਪਣੇ ਬੱਚੇ ਵਾਸਤੇ ਕੋਟੀ ਬਣਾਉਣ ਬਾਰੇ ਸੋਚਿਆ ਵੈਸੇ ਤਾਂ ਮੇਰੇ ਕੋਲ ਉੱਦਾਂ ਹੀ ਬੜੇ ਜ਼ਿਆਦਾ ਸਰੋਤ ਹਨ ਜਿੱਦਾਂ ਕਿ ਹੁਣ ਯੂ ਯੂਟਿਊਬ 'ਤੇ ਉੱਪਰ ਕਿੰਨੇ ਸਾਰੇ ਚੈਨਲ ਹਨ ਮੈਂ ਦੋ ਚੈਨਲ ਤੋਂ ਸਵੈਟਰ ਬਣਾਉਣਾ ਸਿੱਖਿਆ ਜਿਹੜੇ ਕਿ ਕੁਆਟੀਨਿਟੀ ਲਵ ਰੈਡਸਨ ਇੱਦਾਂ ਦੇ ਚੈਨਲ ਹਨ ਇਹਨਾਂ 'ਤੇ ਬੜੇ ਹੀ ਚੰਗੇ ਤਰੀਕੇ ਨਾਲ ਡਿਜ਼ਾਇਨ ਆਉਂਦੇ ਹਨ ਮੈਂ ਸਾਰੀਆਂ ਥਾਵਾਂ ਤੋਂ ਦੇਖ ਕੇ ਆਪਣਾ ਇੱਕ ਡਿਜ਼ਾਇਨ ਅਤੇ ਪੈਟਰਨ ਚੁਣਿਆ ਚੁਣ ਲਿਆ ਅਤੇ ਹੁਣ ਮੈਂ ਉਹਨਾਂ ਨੂੰ ਬੜੀ ਤਰ੍ਹਾਂ ਨਾਲ ਅਤੇ ਮੈਨੂੰ ਉਮੀਦ ਹੈ ਕਿ ਬੜਾ ਸੋਹਣਾ ਸਵੈਟਰ ਬਣਾਵਾਂਗੀ ਧੰਨਵਾਦ ਜੀ